ਮਾਰਸ਼ਲ ਆਰਟ ਦਾ ਅਹਿਮ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੀ ਸੈਲਫ ਸੁਰੱਖਿਆ ਵਾਸਤੇ ਅਤੇ ਇਹ ਮਾਰਸ਼ਲ ਆਰਟ ਦਾ ਸ ਜਿਹੜੀ ਕਲਾ ਸਾਡੇ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਦਿਨ ਬ ਦਿਨ ਸਾਡੀ ਕੋਈ ਸੇਫਟੀ ਨਹੀਂ ਕਿਸੇ ਤਰ੍ਹਾਂ ਤਰੀਕੇ ਨਾਲ ਕਿਉਂਕਿ ਅੱਜ ਕੱਲ੍ਹ ਘਟਨਾਵਾਂ ਹੀ ਇਸ ਤਰ੍ਹਾਂ ਦੀਆਂ ਹੋ ਰਹੀਆਂ ਹੈ ਜੇ ਅਸੀਂ ਬਾਈਕ 'ਤੇ ਸਫਰ ਕਰ ਰਹੇ ਹਾਂ ਜਾਂ ਅਸੀਂ ਗਲੀ ਦੇ ਵਿੱਚ ਪੈਦਲ ਯਾਤਰਾ ਕਰ ਰਹੇ ਹਾਂ ਜਾਂ ਪੈਦਲ ਸਫਰ ਕਰ ਰਹੇ ਹਾਂ ਜਾਂ ਅਸੀਂ ਸੈਰ 'ਤੇ ਜਾ ਰਹੇ ਹਾਂ ਜਾਂ ਸ਼ਾਮ ਨੂੰ ਅਸੀਂ ਸੈਰ 'ਤੇ ਜਾ ਰਹੇ ਹਾਂ ਅਤੇ ਜਿਹੜੇ ਸਨੈਚਰ ਹੈਗੇ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਜਿਹੜਾ ਪਰਸਨ ਸਾਹਮਣੇ ਵਾਲਾ ਜਾ ਰਿਹਾ ਉਹਦੇ ਕੋਈ ਸੱਟ ਫੇਟ ਵੱਜ ਜਾਏਗੀ ਜਾਂ ਉਹਦੇ ਨਾਲ ਕੋਈ ਦੁਰਘਟਨਾ ਅਸੀਂ ਕਰਨ ਜਿਹੜੀ ਅਸੀਂ ਦੁਰਵਿਹਾਰ ਜਾਂ ਦੂਰਘ ਜਿਹੜੀ ਘਟਨਾ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਜਿਹੜੀ ਖਿੱਚਾ ਧੂਈ ਹੈ ਚੋਰ ਜਿਹੜੇ ਹੈਗੇ ਆ ਅੱਜ ਕੱਲ੍ਹ ਕੀ ਕਰਦੇ ਆ ਜੇ ਕੰਨਾਂ ਦੇ ਵਿੱਚ ਵਾਲੀਆਂ ਹੈ ਉਹ ਖਿੱਚਣ ਦੀ ਕੋਸ਼ਿਸ਼ ਕਰਦੇ ਹੈ ਜੇ ਗਲ਼ ਦੇ ਵਿੱਚ ਕੋਈ ਚੈਨ ਪਾਈ ਹੈ ਉਹ ਖਿੱਚਣ ਦੀ ਕੋਸ਼ਿਸ਼ ਕਰਦੇ ਹੈ ਤਾਂ ਇਸ ਲਈ ਇਹਨਾਂ ਚੀਜ਼ਾਂ ਦੀ ਪ੍ਰੋਟੈਕਸ਼ਨ ਪਲਸ ਆਪਣੇ ਆਪ ਨੂੰ ਬਚਾਉਣ ਲਈ ਮਾਰਸ਼ਲ ਆਰਟ ਦਾ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਹੈ ਹਰੇਕ ਬੰਦੇ ਨੂੰ ਔਰ ਹਰੇਕ ਪਰਸਨ ਨੂੰ ਮਾਰਸ਼ਲ ਆਰਟ ਦੀ ਕਲਾ ਦਾ ਸਾਥ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਮਾਰਸ਼ਲ ਆਰਟ ਹੀ ਹੈ ਜਿਹੜਾ ਆਪਣੇ ਆਪ ਨੂੰ ਅਸੀਂ ਜਿਹਦੇ ਨਾਲ ਸੁਰੱਖਿਅਤ ਰੱਖ ਸਕਦੇ ਹਾਂ ਅਤੇ ਜਿੱਥੋਂ ਤੱਕ ਜਿੱਥੋਂ ਤੱਕ ਹੋ ਸਕਦਾ ਹੈ ਵੱਧ ਤੋਂ ਵੱਧ ਆਪਣੇ ਆਪ ਨੂੰ ਇਹਨਾਂ ਚੋਰਾਂ ਤੋਂ ਜਾਂ ਅਣਸੁਖਾਵੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ